ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਭਾਅ ਜੀ ਹੋਰ ਭਾਅ ਜੀ ਹੋਰ ਸਭ ਵਧੀਆ ਜੀ ਹੋਰ ਭਾਅ ਜੀ ਸ਼ਗਨ ਢਾਬੇ ਤੋਂ ਬੋਲਦੇ ਭਾਅ ਜੀ ਭਾਅ ਜੀ ਆਪਾਂ ਨਾ ਤੁਹਾਡੇ ਢਾਬੇ 'ਤੇ ਨਾ ਪਾਰਟੀ ਵਗੈਰਾ ਕਰਨੀ ਸੀਗੀ ਇੱਕ ਜਨਮ ਦਿਨ ਸੀਗਾ ਮੇਰਾ ਆਪਾਂ ਉਹ ਸੈਲੀਬ੍ਰੇਟ ਕਰਨਾ ਸੀਗਾ ਮੈਂ ਤੁਹਾਡੇ ਤੋਂ ਉਹ ਪੁੱਛਣਾ ਸੀਗਾ ਪਹਿਲਾਂ ਤਾਂ ਪੁੱਛਣਾ ਸੀਗਾ ਜਿੱਦਾਂ ਹੁਣ ਖਾਣੇ ਦੀਆਂ ਵੀ ਖਾਣੇ 'ਚ ਸਾਨੂੰ ਕਿਆ ਕੁਛ ਮਿਲ ਜੂਗਾ ਕਿਉਂਕਿ ਆਪਾਂ ਭਾਅ ਜੀ ਜਿੱਦਾਂ ਹੁਣ ਜਨਮ ਦਿਨ ਸੈਲੀਬ੍ਰੇਟ ਕਰਨਾ ਇੱਕ ਸਾਨੂੰ ਤਾਂ ਹਾਲ ਚਾਹੀਦਾ ਹੈਗਾ ਹੈ ਖੁੱਲ੍ਹਾ ਉਹ ਤੋਂ ਇਲਾਵਾ ਖਾਣ ਵਿੱਚ ਸਾਨੂੰ ਚਾਹੀਦਾ ਜਿੱਦਾਂ ਸ਼ਾਹੀ ਪਨੀਰ ਹੋ ਗਿਆ ਮਟਰ ਪਨੀਰ ਹੋ ਗਿਆ ਦਾਲ ਵਗੈਰਾ ਹੋ ਗਿਆ ਚਪਾਤੀਆਂ ਹੋ ਗਈਆਂ ਉਹ ਤੋਂ ਬਾਅਦ ਛੋਲੇ ਭਟੂਰੇ ਵਗੈਰਾ ਅਤੇ ਇਹ ਤੋਂ ਇਲਾਵਾ ਹੋਰ ਵੀ ਕੁਛ ਸਾਨੂੰ ਡ੍ਰਿੰਕਸ ਵਗੈਰਾ ਚਾਹੀਦੀਆਂ ਹੈਗੀਆਂ ਹੈ ਉਹਦੇ ਬਾਰੇ ਪੁੱਛਣਾ ਸੀਗਾ ਵੀ ਸਾਨੂੰ ਇਹ ਸਭ ਚੀਜ਼ਾਂ ਮਿਲ ਜੂਗੀਆਂ ਉੱਥੇ ਉਹ ਤੋਂ ਇਲਾਵਾ ਦੇਖਣਾ ਸੀਗਾ ਜਿੱਦਾਂ ਹੁਣ ਭਾਅ ਜੀ ਆਪਾਂ ਜਨਮਦਿਨ ਸੈਲੀਬ੍ਰੇਟ ਕਰਨਾ ਹੈਗਾ ਹੈ ਉਹਦੇ ਵਾਸਤੇ ਸਾਨੂੰ ਅਲੱਗ ਤੋਂ ਇੱਕ ਸੈਪਰੇਟ ਤੋਂ ਜਿੱਦਾਂ ਹਾਲ ਵਗੈਰਾ ਨਹੀਂ ਹੁੰਦਾ ਹੈਗਾ ਹੈ ਸੈਲੀਬ੍ਰੇਟ ਕਰਨ ਵਾਸਤੇ ਮੈਂ ਉਹ ਪੁੱਛਣਾ ਸੀਗਾ ਸਾਨੂੰ ਉਹ ਭਾਅ ਜੀ ਮਿਲ ਜੂਗਾ ਉਹ ਤੋਂ ਇਲਾਵਾ ਭਾਅ ਜੀ ਇੱਕ ਮੈਂ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਦੀਆਂ ਜਿੱਦਾਂ ਹੁਣ ਆਪਾਂ ਦਸ ਪੰਦਰਾਂ ਜਣੇ ਹੋਣੇ ਹੈ ਘੱਟੋ ਘੱਟ ਆਪਾਂ ਪੰਜ ਚਾਰ ਗੱਡੀਆਂ 'ਚ ਆਉਣਾ ਹੈ ਕਿਉਂਕਿ ਮੇਰੇ ਦੋਸਤਾਂ ਨੇ ਬਾਹਰ ਤੋਂ ਵੀ ਆਉਣਾ ਹੈਗਾ ਹੈ ਉਹ ਪੁੱਛਣਾ ਸੀਗਾ ਜਿੱਦਾਂ ਹੁਣ ਭਾਅ ਜੀ ਆਪਾਂ ਬਾਹਰ ਤੋਂ ਆਉਣਾ ਹੈਗਾ ਹੈ ਉੱਥੇ ਪਾਰਕਿੰਗ ਵਗੈਰਾ ਦਾ ਪ੍ਰਬੰਧ ਅੱਛਾ ਹੈਗਾ ਹੈ ਉਹ ਤੋਂ ਇਲਾਵਾ ਭਾਅ ਜੀ ਇੱਕ ਜਿੱਦਾਂ ਇੱਕ ਹੋਰ ਜਿਹੜੀ ਦੂਜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਕ ਸਾਡੀ ਭਾਅ ਜੀ ਹੈਗੀ ਹੈ ਟਾਈਮਿੰਗ ਦੀ ਮੈਂ ਇੱਕ ਭਾਅ ਜੀ ਟਾਈਮਿੰਗ ਪੁੱਛਣੀ ਸੀਗੀ ਤੁਹਾਡੇ ਤੋਂ ਵੀ ਟਾਈਮਿੰਗ ਮਤਲਬ ਕਿੰਨੇ ਕੁ ਟਾਈਮ ਤੱਕ ਢਾਬਾ ਬੰਦ ਹੋ ਜੂਗਾ ਉਹਦਾ ਪੁੱਛਣਾ ਹੈਗਾ ਨਾ ਉਹਦੇ ਹਿਸਾਬ ਨਾਲ ਭਾਅ ਜੀ ਪਲੈਨਿੰਗ ਕਰਨੀ ਹੈਗੀ ਨਾ ਕਿਉਂਕਿ ਮੇਰੇ ਸਾਰੇ ਭਾਅ ਜੀ ਜੋਬ ਵਾਲੇ ਹੈਗੇ ਹੈ ਉਹ ਤੋਂ ਜੋਬ ਤੋਂ ਬਾਅਦ ਆਉਣਾ ਹੈਗਾ ਭਾਅ ਜੀ ਉੱਥੇ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਠੀਕ ਆ ਭਾਅ ਜੀ ਧੰਨਵਾਦ ਜੀ